ਸਕੂਲਾਂ ਦੇ ਵਿੱਚ ਅੱਜ ਕੱਲ੍ਹ ਵਿਦਿਆਰਥੀਆਂ ਨੂੰ ਸਿਰਫ ਪਾਠਕ੍ਰਮ ਤੱਕ ਹੀ ਸੀਮਤ ਨਹੀਂ ਰੱਖਿਆ ਜਾਂਦਾ ਬਲਕਿ ਉਹਨਾਂ ਨੂੰ ਪਾਠਕ੍ਰਮ ਤੋਂ ਬਿਨਾਂ ਹੋਰ ਵੱਖ ਵੱਖ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਖੇਡਾਂ ਦੇ ਵਿੱਚ ਅਤੇ ਹੋਰ ਗਤੀਵਿਧੀਆਂ ਦੇ ਵਿੱਚ ਵੀ ਭਾਗ ਦਿਵਾਇਆ ਜਾਂਦਾ ਹੈ ਤਾਂ ਕਿ ਜਿਹੜੇ ਵਿਦਿਆਰਥੀ ਨੇ ਉਹ ਸਿਰਫ ਪੁਸਤਕਾਂ ਤੱਕ ਹੀ ਸੀਮਤ ਨਾ ਰਹਿ ਸਕਣ ਅਤੇ ਹੋਰ ਵੀ ਗਤੀਵਿਧੀਆਂ ਰਾਹੀਂ ਉਹ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਮਨਪਸੰਦ ਖੇਤਰ ਦੇ ਵਿੱਚ ਜਾ ਸਕਣ ਕਿਉਂਕਿ ਕਈ ਵਿਦਿਆਰਥੀ ਖੇਡਾਂ ਦੇ ਵਿੱਚ ਚੰਗੇ ਹੁੰਦੇ ਨੇ ਅਤੇ ਕਈ ਵਿਦਿਆਰਥੀ ਨੇ ਜਿਹੜੇ ਉਹ ਹੋਰ ਜੋ ਸਕੂਲਾਂ ਦੇ ਵਿੱਚ ਮੁਕਾਬਲੇ ਕਰਵਾਏ ਜਾਂਦੇ ਨੇ ਉਨ੍ਹਾਂ ਦੇ ਵਿੱਚ ਉਹ ਵਧੀਆ ਹੁੰਦੇ ਨੇ ਇਸ ਕਰਕੇ ਸਿਰਫ ਪਾਠਕ੍ਰਮ ਤੱਕ ਸੀਮਤ ਰਹਿਣਾ ਅੱਜ ਕੱਲ੍ਹ ਦੇ ਸਮੇਂ ਵਿੱਚ ਮਤਲਬ ਬਹੁਤਾ ਮਹੱਤਵ ਨਹੀਂ ਰੱਖਦਾ ਜ਼ਿਆਦਾ ਜਿਹੜਾ ਦੂਸਰੀਆਂ ਗਤੀਵਿਧੀਆਂ ਨੇ ਉਹ ਵੀ ਵਿਦਿਆਰਥੀਆਂ ਨੂੰ ਇਸ ਕਰਕੇ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਸੇ ਵੀ ਜਿਹੜੇ ਮੁਕਾਬਲੇ ਦੇ ਵਿੱਚ ਜਾ ਸਕਦਾ ਹੋਵੇ ਭਾਗ ਲੈ ਸਕਦਾ ਹੋਵੇ ਅਤੇ ਆਪਣਾ ਜਿਹੜਾ ਮੁਕਾਮ ਹੈ ਉਹ ਉਹਨਾਂ ਖੇਤਰਾਂ ਦੇ ਵਿੱਚ ਅੱਗੇ ਵੱਧ ਕੇ ਹਾਸਲ ਕਰ ਸਕਦਾ ਹੋਵੇ ਮੈਂ ਵੀ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਹੈ ਮੈਂ ਖੇਡਾਂ ਦੇ ਵਿੱਚ ਵੀ ਹਿੱਸਾ ਲੈਂਦੀ ਰਹੀ ਹਾਂ ਖੇਡਾਂ ਦੇ ਵਿੱਚੋਂ ਮੈਨੂੰ ਦੌੜ ਜਿਹੜੀ ਹੈਗੀ ਬਹੁਤ ਪਸੰਦ ਹੈ ਮੇਰੀ ਮਨਪਸੰਦ ਖੇਡ ਰਹੀ ਹੈ ਮੈਂ ਚਾਰ ਸੌ ਮੀਟਰ ਦੌੜ ਦੇ ਵਿੱਚ ਕਾਫੀ ਵਾਰ ਹਿੱਸਾ ਲਿਆ ਅਤੇ ਕਈ ਵਾਰੀ ਇਨਾਮ ਵੀ ਪ੍ਰਾਪਤ ਕੀਤਾ ਹੈ